ਵੈਸੇ ਤਾਂ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਐਵੇਂ ਦੇ ਪਲ ਹਨ ਜਿਨ੍ਹਾਂ ਨੂੰ ਸੋਚ ਕੇ ਮੈਨੂੰ ਬਹੁਤ ਜ਼ਿਆਦਾ ਮਾਣ ਪ੍ਰਾਪਤ ਹੁੰਦਾ ਹੈ ਪਰ ਮੇਰੀ ਜ਼ਿੰਦਗੀ ਵਿੱਚ ਇੱਕ ਐਵੇਂ ਦਾ ਵੀ ਪਲ ਸੀ ਜਿਸਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕਦੀ ਜਦੋਂ ਮੈਂ ਦਸਵੀਂ ਕਲਾਸ ਵਿੱਚ ਪੜ੍ਹਦੀ ਹੁੰਦੀ ਸੀ ਤਾਂ ਮੇਰੇ ਪੂਰੇ ਜਿਲ੍ਹੇ ਵਿੱਚੋਂ ਸਭ ਤੋਂ ਵੱਧ ਨੰਬਰ ਆਏ ਸੀ ਜਿਸ ਕਾਰਨ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਸੀ ਮੋਹਾਲੀ ਪੰਜਾਬੀ ਸੱਥ ਵਿੱਚ ਜਿੱਥੇ ਮੈਨੂੰ ਬਹੁਤ ਜ਼ਿਆਦਾ ਸਨਮਾਨ ਪ੍ਰਾਪਤ ਹੋਇਆ ਉੱਥੇ ਬਹੁਤ ਸਾਰੇ ਬੜੇ ਬੜੇ ਅਧਿਕਾਰੀ ਆਏ ਹੋਏ ਸਨ ਸਿੱਖਿਆ ਮੰਤਰੀ ਡੀ ਸੀ ਇਹ ਸਭ ਆਏ ਹੋਏ ਸਨ ਅਤੇ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਅਤੇ ਮੈਨੂੰ ਬਹੁਤ ਸਾਰੀਆਂ ਇਤਿਹਾਸਿਕ ਕਿਤਾਬਾਂ ਅਤੇ ਇੱਕ ਸ਼ੀਲਡ ਨਾਲ਼ ਸਨਮਾਨਿਤ ਕੀਤਾ ਗਿਆ ਮੇਰੇ ਪਿਤਾ ਜੀ ਵੀ ਉਸ ਸਮੇਂ ਮੇਰੇ ਨਾਲ਼ ਸੀਗੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸਨਮਾਨਿਤ ਕੀਤਾ ਅਤੇ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਉਸ ਸਮੇਂ ਮੇਰੀ ਖੁਸ਼ੀ ਦਾ ਕੋਈ ਅੰਦਾਜ਼ਾ ਨਹੀਂ ਸੀ ਕਿਉਂਕਿ ਮੈਨੂੰ ਪਹਿਲੀ ਵਾਰ ਐਵੇਂ ਦਾ ਕੁਝ ਇਤਿਹਾਸਿਕ ਪਲ ਮੇਰੀ ਜ਼ਿੰਦਗੀ ਦੇ ਵਿੱਚ ਆਇਆ ਸੀ ਅਤੇ ਮੇਰੇ ਲਈ ਇਸ ਤੋਂ ਵੱਡੀ ਮਾਣ ਵਾਲ਼ੀ ਕੋਈ ਗੱਲ ਨਹੀਂ ਸੀ ਅਤੇ ਉਹਨਾਂ ਦੁਆਰਾ ਫਿਰ ਮੈਨੂੰ ਬਹੁਤ ਜ਼ਿਆਦਾ ਸਨਮਾਨਿਤ ਕੀਤਾ ਗਿਆ ਅਤੇ ਮੇਰੇ ਟੀਚਰ ਵੀ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਸੀਗਾ ਅਤੇ ਉਹਨਾਂ ਨੇ ਵੀ ਮੇਰੇ ਮੇਰੇ ਲਈ ਬਹੁਤ ਵਧੀਆ ਵਧੀਆ ਗੱਲਾਂ ਕਹੀਆਂ ਜੋ ਮੈਨੂੰ ਅੱਜ ਤੱਕ ਯਾਦ ਨੇ ਜਦੋਂ ਮੈਂ ਜਦੋਂ ਮੈਂ ਇਹ ਸਪੀਚ ਸੁਣੀ ਤਾਂ ਮੇਰੀ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਮੇਰੇ ਫਾਦਰ ਵੀ ਉੱਥੇ ਖੜ੍ਹ ਕੇ ਕਲੈਪਿੰਗ ਕਰਨ ਲੱਗ ਪਏ ਅਤੇ ਉਸ ਤੋਂ ਬਾਅਦ ਸਾਨੂੰ ਮੇਰੇ ਟੀਚਰਾਂ ਨੇ ਖਾਣਾ ਵੀ ਖਵਾਇਆ ਅਤੇ ਅਸੀਂ ਘਰ ਵਾਪਸ ਆ ਗਏ ਪਰ ਜਦੋਂ ਦੂਜੇ ਦਿਨ ਮੈਂ ਉਹ ਖਬਰ ਅਖਬਾਰ ਵਿੱਚ ਦੇਖੀ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸਾਰੇ ਰਿਸ਼ਤੇਦਾਰਾਂ ਨੇ ਮੈਨੂੰ ਬਹੁਤ ਵਧਾਈਆਂ ਦਿੱਤੀਆਂ ਇਹ ਮੇਰੀ ਸਭ ਤੋਂ ਵੱਡੀ ਮਾਣ ਵਾਲੀ ਪ੍ਰਾਪਤੀ ਸੀ